ਸਤਿ ਸ਼੍ਰੀ ਅਕਾਲ ਪੰਜਾਬੀ ਸਭਿਆਚਾਰ ਵਿੱਚ ਭੰਗੜਾ ਇੱਕ ਬਹੁਤ ਮਹੱਤਵ ਹੈ ਪੰਜਾਬੀ ਸਭਿਆ ਦੇ ਚਾਰ ਵਿੱਚ ਜਿੱਦਾਂ ਕਿ ਅਸੀਂ ਸਾਨੂੰ ਪਤਾ ਹੀ ਹੈ ਕਿ ਪੰਜਾਬੀ ਸਭਿਆਚਾਰ ਵਿੱਚ ਭੰਗੜਾ ਬੜਾ ਹੀ ਜ਼ਿਆਦਾ ਮਹੱਤਵ ਹੈ ਪੰਜਾਬੀ ਸੱਭਿਆਚਾਰ ਵਿੱਚ ਭੰਗੜੇ ਦੀ ਬਹੁਤ ਵੈਲਿਊ ਹੈ ਅਤੇ ਭੰਗੜੇ ਦੇ ਵਿੱਚ ਮਤਲਬ ਭੰਗੜਾ ਮੁੰਡਿਆਂ ਜ਼ਿਆਦਾਤਰ ਮੁੰਡੇ ਹੀ ਕਰਦੇ ਹਨ ਅ ਜੇ ਜੇ ਕਿਸੇ ਦਾ ਜਨਮ ਦਿਨ ਜਾਂ ਕਿਸੇ ਦੀ ਅ ਕਿਸੇ ਦਾ ਪ੍ਰੋਗਰਾਮ ਹੋਵੇ ਤਾਂ ਭੰਗੜਾ ਭੰਗੜਾ ਕੀਤਾ ਜਾਂਦਾ ਹੈ ਭੰਗੜੇ ਅ ਭੰਗੜਾ ਅਤੇ ਗਿੱਧਾ ਦੋ ਜੋ ਦੋ ਜਿਹੜੇ ਮਹੱਤਵ ਜਿਹੜੇ ਹਨ ਭੰਗੜੇ ਮਹੱਤਵ ਤਿਉਹਾਰਾਂ ਵਿੱਚ ਮਨਾਏ ਜਾਂਦੇ ਹਨ ਪੰਜਾਬੀ ਸੱਭਿਆਚਾਰ ਵਿੱਚ ਅਤੇ ਜਿਹੜਾ ਪੰਜਾਬੀ ਸੱਭਿਆਚਾਰ ਹੈ ਅ ਪੰਜਾਬੀ ਸੱਭਿਆਚਾਰ ਵਿੱਚ ਭੰਗੜਾ ਭੰਗੜਾ ਮੁੰਡਿਆਂ ਦਾ ਨਾਚ ਹੁੰਦਾ ਹੈ ਮੁੰਡੇ ਭੰਗੜੇ ਦੇ ਬਹੁਤ ਜ਼ਿਆਦਾ ਸਟੈਪਸ ਹੁੰਦੇ ਹਨ ਵਿਸਾਖੀ ਦੇ ਵਿੱਚ ਜਦੋਂ ਅ ਵਿਸਾਖੀ ਵਾਲੇ ਦਿਨ ਵੀ ਭੰਗੜਾ ਭੰਗੜਾ ਕੀਤਾ ਜਾਂਦਾ ਹੈ ਅਤੇ ਕੁੜੀਆਂ ਗਿੱਧਾ ਕੁੜੀ ਕੁੜੀਆਂ ਕਰਦੀਆਂ ਹਨ ਅਤੇ ਮੁੰਡੇ ਮੁੰਡੇ ਮਤਲਬ ਭੰਗੜਾ ਕਰਦੇ ਹਨ ਅਤੇ ਅ ਲੋਹੜੀ ਵਾਲੇ ਦਿਨ ਵੀ ਭੰਗੜਾ ਕੀਤਾ ਜਾਂਦਾ ਹੈ ਸਾਰੇ ਅ ਰਲ ਮਿਲ ਕੇ ਲੋਹੜੀ ਦਾ ਤਿਉਹਾਰ ਮਨਾਉਂਦੇ ਹਨ ਅਤੇ ਭੰਗੜਾ ਭੰਗੜਾ ਕਰਦੇ ਹਨ